ਜਦੋਂ ਬਾਈਕਿੰਗ ਕੀਤੀ ਜਾਂਦੀ ਹੈ ਤਾਂ ਅਸੀਂ ਬਹੁਤ ਸਾਰੇ ਖੇਤਰਾਂ ਵਿੱਚ ਲੋਕ ਅਲੱਗ ਅਲੱਗ ਤਰ੍ਹਾਂ ਦੇ ਲੋਕਾਂ ਨੂੰ ਮਿਲਦੇ ਹਾਂ ਉਸ ਵਿੱਚ ਸਾਨੂੰ ਅਮੀਰ ਵੀ ਮਿਲਦੇ ਹਨ ਗਰੀਬ ਵੀ ਮਿਲਦੇ ਹਨ ਅਤੇ ਮੱਧਮ ਦਰਜੇ ਦੇ ਲੋਕ ਵੀ ਮਿਲਦੇ ਹਨ ਇਹਨਾਂ ਵਿੱਚ ਅਸੀਂ ਸਮਾਜਿਕ ਸਮਾਨਤਾਵਾਂ ਦੀ ਭਾਵਨਾ ਭਾਵਨਾਵਾਂ ਲਈ ਉਤਸਾਹਿਤ ਕਰ ਸਕਦੇ ਹਾਂ ਉਹਨਾਂ ਨੂੰ ਇੱਕ ਬਾਈਕਿੰਗ ਕਰਨ ਵਾਲਾ ਬੰਦਾ ਅ ਕਿਉਂਕਿ ਉਸਨੇ ਅਲੱਗ ਅਲੱਗ ਜਗ੍ਹਾ 'ਤੇ ਜਾਣਾ ਹੁੰਦਾ ਹੈ ਬਹੁਤ ਕੁਛ ਦੱਸ ਸਕਦਾ ਹੈ ਕਿ ਦੂਸਰੇ ਜਦੋਂ ਉਹ ਦੂਸਰੇ ਪ੍ਰਦੇਸ਼ਾਂ ਵਿੱਚ ਵਿਜਿਟ ਕਰਨ ਜਾਂਦਾ ਹੈ ਜਾਂ ਘੁੰਮਣ ਜਾਂਦਾ ਹੈ ਬਾਈਕਿੰਗ ਕਰਨ ਜਾਂਦਾ ਹੈ ਤਾਂ ਉੱਥੇ ਦੇ ਲੋਕ ਕਿਸ ਤਰ੍ਹਾਂ ਨਾਲ ਕਿੰਨੇ ਪਿਆਰ ਨਾਲ ਅਤੇ ਇੱਕ ਦੂਜੇ ਨਾਲ ਮਿਲਵਰਤਨ ਨਾਲ ਰਹਿੰਦੇ ਹਨ ਬਾਈਕਿੰਗ ਸਾਨੂੰ ਇਹ ਸਿਖਾਉਂਦੀ ਹੈ ਕਿ ਅਸੀਂ ਲੋ ਅਲੱਗ ਅਲੱਗ ਤਰ੍ਹਾਂ ਦੇ ਲੋਕਾਂ ਨੂੰ ਮਿਲਦੇ ਹਾਂ ਉਹਨਾਂ ਦੀ ਭਾਵਨਾਵਾਂ ਨੂੰ ਜਾਣ ਸਮਝਦੇ ਹਾਂ ਜਾਣਦੇ ਹਾਂ ਉਹਨਾਂ ਨੂੰ ਦੇ ਵਿੱਚ ਪਿਆਰ ਭਰਿਆ ਵਾਤਾਵਰਣ ਦੇ ਪਾਉਣ ਦੀ ਉਤਸਾਹਿਤ ਕਰਦੇ ਹਨ ਇੱਕ ਬਾਈਕਰ ਜਿਹੜਾ ਹੈ ਉਹ ਚੰਗੀ ਭਾਵਨਾ ਦਾ ਸੰਕੇਤ ਦਿੰਦਾ ਹੈ ਕਿਉਂਕਿ ਉਸਨੇ ਜਾ ਕੇ ਤਰ੍ਹਾਂ ਤਰ੍ਹਾਂ ਦੇ ਲੋਕਾਂ ਨੂੰ ਮਿਲਣਾ ਹੁੰਦਾ ਹੈ ਉਹ ਲੋਕ ਅਮੀਰ ਵੀ ਹੁੰਦੇ ਹਨ ਗਰੀਬ ਵੀ ਹੁੰਦੇ ਹਨ ਛੋਟੀ ਜਾਤ ਦੇ ਵੀ ਹੁੰਦੇ ਹਨ ਅਤੇ ਵੱਡੀ ਜਾਤ ਦੇ ਹੁੰਦੇ ਹਨ ਅਤੇ ਉਹਦੇ ਵਿੱਚ ਭੇਦ ਭਾਵ ਖਤਮ ਹੋ ਜਾਂਦਾ ਹੈ ਅਤੇ ਸਾਰੇ ਉਸ ਦਾ ਸਵਾਗਤ ਕਰਦੇ ਹਨ ਉਸਨੂੰ ਬੜੀ ਖੁਸ਼ੀ ਨਾਲ ਮਿਲਦਾ ਤਾਂ ਉਹ ਇੱਕ ਤਰ੍ਹਾਂ ਦਾ ਚਿੰਨ ਹੁੰਦਾ ਹੈ ਇਕੱਠ ਦਾ ਸਮਾਜਿਕ ਇਕੱਠ ਦਾ ਇਸ ਨਾਲ ਸਮਾਜਿਕ ਇਕੱਠ ਵੀ ਹੁੰਦਾ ਹੈ ਪਿਆਰ ਵੀ ਵੱਧਦਾ ਹੈ ਲੋਕ ਆਪਸ ਵਿੱਚ ਉੱਥੇ ਮਿਲਦੇ ਹਨ ਅਤੇ ਉਹ ਆਪਣੇ ਭਾਵ ਵੀ ਪ੍ਰਗਟ ਕਰਦਾ ਹੈ